ਸਤਿ ਸ਼੍ਰੀ ਅਕਾਲ ਭਾਜੀ ਮੈਂ ਤੁਹਾਡੀ ਦੁਕਾਨ ਤੋਂ ਕੈਮਰਾ ਲਿਆ ਸੀ ਹਾਂਜੀ ਉਹ ਸ਼ਿਵ ਵਰਮਾ ਦੁਕਾਨ ਤੋਂ ਗੱਲ ਕਰ ਰਹੇ ਹੋ ਨਾ ਤੁਸੀਂ ਤੇ ਮੈਂ ਨਾ ਤੁਹਾਡੀ ਦੁਕਾਨ ਤੋਂ ਕੈਮਰਾ ਲਿਆ ਸੀ ਕੈਨਨ ਦੋ ਸੌ ਡੀ ਉਹ ਕੈਮਰੇ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਏ ਆ ਅਤੇ ਨਾ ਤਾਂ ਉਹਦਾ ਜਿਹੜਾ ਡੀ ਐੱਸ ਐੱਲ ਆਰ ਫੌਕਸ ਹੋ ਨਹੀਂ ਰਿਹਾ ਪਰੋਪਰ ਐਨ ਜੇ ਕੋਈ ਵੀਡਿਓ ਬਣਾਉਂਦੇ ਹਾਂ ਜਾਂ ਫੋਟੋ ਖਿੱਚਦੇ ਹਾਂ ਭਾਜੀ ਆਪਾਂ ਉੱਧਰਲੀ ਸਾਈਡ ਫੌਕਸ ਨਹੀਂ ਹੋ ਰਿਹਾ ਅਤੇ ਉਹਦੀ ਜਿਹੜੀ ਬੈਟਰੀ ਹੈ ਉਹ ਬੈਟਰੀ ਜ਼ਿਆਦਾ ਟਾਈਮ ਨਹੀਂ ਕੱਢ ਰਹੀ ਹੈ ਅਤੇ ਉਹ ਐਂ ਲੱਗ ਰਿਹਾ ਜਿੱਦਾਂ ਕੈਮਰੇ ਦੇ ਵਿੱਚ ਨਾ ਕੋਈ ਚੀਜ਼ ਖੜਕ ਰਹੀ ਹੋਵੇ ਅਤੇ ਬਲੈਕ ਕਲਰ ਦਾ ਕੈਮਰਾ ਨਵਾਂ ਭਾਜੀ ਕੈਮਰਾ ਉਹ ਕੈਮਰੇ ਦੇ ਵਿੱਚ ਇੱਦਾਂ ਨਵਾਂ ਤੁਹਾਨੂੰ ਪਤਾ ਪੰਜਾਹ ਸੱਠ ਹਜ਼ਾਰ ਰੁਪਇਆ ਲਾਇਆ ਅਤੇ ਉਹ ਇੱਦਾਂ ਫਿਰ ਸਮੱਸਿਆ ਆਵੇ ਫਿਰ ਦੁਕਾਨਦਾਰੀ ਤੁਹਾਡੀ ਵੀ ਖ਼ਰਾਬ ਹੁੰਦੀ ਹੈ ਕਸਟਮਰ ਵੀ ਤੁਹਾਡਾ ਖ਼ਰਾਬ ਹੁੰਦਾ ਆ ਇਸ ਤੋਂ ਬੈਟਰ ਤਾਂ ਭਾਜੀ ਇਹ ਹੀ ਚੀਜ਼ ਹੈ ਕਿ ਤੁਸੀਂ ਮੈਨੂੰ ਐਂ ਕਰੋ ਕਿ ਮੈਨੂੰ ਨਾ ਉਹ ਕੈਮਰਾ ਬਦਲ ਕੇ ਦੇ ਦਿਓ ਮੈਂ ਤੋਹਾਤੋਂ ਕੋਈ ਕੈਸ਼ ਵਾਪਸ ਨਹੀਂ ਮੰਗ ਰਿਹਾ ਮੈਂ ਕੁਝ ਥੋਹਾਤੋਂ ਇੱਦਾਂ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਮੈਨੂੰ ਕੈਮਰਾ ਬਦਲ ਕੇ ਦੇ ਦਿਓ ਉਹ ਮੈਂ ਰੀਕਓਸਟ ਹੀ ਤੁਹਾਨੂੰ ਕਰ ਸਕਦਾ ਏ ਹਾਂ ਬਾਕੀ ਤੁਹਾਨੂੰ ਮੈਂ ਦੱਸਿਆ ਏ ਕਿ ਨਾ ਤਾਂ ਉਹਦਾ ਡੀ ਐੱਸ ਐੱਲ ਆਰ ਪਰੋਪਰ ਤਰੀਕੇ ਦੇ ਨਾਲ ਹੋ ਰਿਹਾ ਏ ਨਾ ਉਹਦਾ ਫੌਕਸ ਪਰੋਪਰ ਵੀਡਿਓ ਫੋਟੋ ਦੇ ਵਿੱਚ ਉਹ ਕਰ ਰਿਹਾ ਆ ਉੱਪਰ ਤੋਂ ਉਹਦੇ ਖੜਕਣ ਦੀ ਅੰਦਰੋਂ ਅਵਾਜ਼ ਆਉਂਦੀ ਹੈ ਕਿ ਜਿੱਦਾਂ ਕੋਈ ਨੱਟ ਨੁੱਟ ਜੇ ਕੋਈ ਟੁੱਟਿਆ ਹੁੰਦਾ ਸਮਾਨ ਅੰਦਰ ਉਹ ਚੀਜ਼ ਖੜਕ ਰਹੀਂ ਹੁੰਦੀ ਹੈ ਬੈਟਰੀ ਉਹਦੀ ਨਹੀਂ ਜ਼ਿਆਦਾ ਟੈਮ ਕੱਢ ਰਹੀ ਹੈ ਜਦ ਕਿ ਮੈਂ ਤੁਹਾਡੀ ਸ਼ੋਪ ਦੇ ਵਿੱਚੋਂ ਕੈਮਰਾ ਐਨ ਪੈਕਿੰਗ ਸੀਲ ਬੰਦ ਲਿਆ ਸੀ ਨਵੀਂ ਸੀਲ ਬੰਦ ਕੈਮਰੇ ਦੇ ਵਿੱਚ ਵੀਰ ਜੀ ਦਿੱਕਤ ਆਉਣੀ ਨਹੀਂ ਵੈਸੇ ਇਹ ਚਾਹੀਦੀ ਆ ਬਾਕੀ ਤੁਹਾਨੂੰ ਜਿੱਦਾਂ ਠੀਕ ਲੱਗੇ ਤੁਸੀਂ ਉੱਦਾਂ ਦੇਖ ਲਓ ਬਾਕੀ ਨਹੀਂ ਤਾਂ ਕਸਟਮਰ ਖ਼ਰਾਬ ਹੋਣ ਦੀ ਗੱਲ ਹੈ ਜੀ ਓਕੇ ਜੀ